ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਏ ਕੇ ਟਰੈਵਲ ਏਜਂਟ ਤੋਂ ਗੱਲ ਕਰਦੇ ਹੋ ਮੈਂ ਸਰ ਵਰਿੰਦਰ ਸਿੰਘ ਗੱਲ ਕਰ ਰਹੇ ਹਾਂ ਹੋਸ਼ਿਆਰਪੁਰ ਤੋਂ ਮੈਂ ਨਾ ਮਹਾਕੁੰਮ ਤੇ ਜਾਣਾ ਸੀ ਤੇ ਟ੍ਰੇਨ ਦੇ ਵੇਰਵੇ ਤੋਂ ਪਤਾ ਕਰਨਾ ਸੀ ਮੈਂ ਚੋਦਾਂ ਤਰੀਕ ਨੂੰ ਮਾਰਚ ਦੋ ਜਾਰ ਪੱਚੀ ਨੂੰ ਟਰੇਨ ਰਾਹੀਂ ਮਹਾਂ ਕੁੰਭ ਮੇਲੇ ਤੇ ਜਾਣਾ ਚਾਹੁੰਦਾ ਹਾਂ ਇਹਦੇ ਲਈ ਮੈਨੂੰ ਦੱਸੋ ਵੀ ਕਿਹੜੀਆਂ ਕਿਹੜੀਆਂ ਟ੍ਰੇਨਾਂ ਉਸ ਦਿਨ ਮੈਨੂੰ ਮਿਲ ਸਕਦੀਆਂ ਹਨ ਤਾਂ ਜੋ ਮੈਂ ਸਮਾਂ ਮਿਲਾ ਕੇ ਤੁਹਾਨੂੰ ਦੱਸਾਂਗਾ ਕਿ ਮੇਰੇ ਲਈ ਕਿਹੜੀ ਟ੍ਰੇਨ ਬੁੱਕ ਕਰ ਦਿਓ ਤਾਂ ਜੋ ਮੈਂ ਆਣ ਜਾਣ ਲਈ ਸੌਖਾ ਹੋ ਸਕੇ ਤੇ ਮੇਰੀ ਕੁਝ ਹੈਲ ਮਦਦ ਹੋ ਸਕੇ ਠੀਕ ਸਰ ਠੀਕ ਹ ਤੇ ਇਹਦੇ ਲਈ ਮੈਨੂੰ ਇਹ ਦੱਸਿਓ ਕਿ ਖਰਚਾ ਕਿੰਨਾ ਹੋ ਜਾਊਗਾ ਤੇ ਮੇਰੇ ਆਣ ਜਾਣ ਚੋ ਮੈਨੂੰ ਕਿਹੜੇ ਕਿਹੜੇ ਸਹੂਲਤਾਂ ਮਿਲਜੂਗੀਆਂ ਠੀਕ ਤੇ ਉੱਥੇ ਮੈਨੂੰ ਰਸਤੇ ਵਿੱਚ ਕੋਈ ਤੰਗੀ ਤਾਂ ਨਹੀਂ ਹੋਊਗੀ ਜੀ ਠੀਕ ਹ ਠੀਕ ਹ ਜੀ ਠੀਕ ਹ ਸਮਝ ਗਿਆ ਜੀ ਬਾਕੀ ਜੇ ਕੋਈ ਰਸਤੇ ਵਿੱਚ ਮੈਨੂੰ ਦਿੱਕਤ ਪਰੇਸ਼ਾਨੀ ਆਈ ਹ ਮੈਂ ਤੁਹਾਨੂੰ ਫੋਨ ਵੀ ਕਰ ਲਉਂਗਾ ਤਾਂ ਜੋ ਰਸਤੇ ਵਿੱਚ ਮੈਨੂੰ ਕੋਈ ਪ੍ਰੋਬਲਮ ਹੋਈ ਤਾਂ ਤੁਸੀਂ ਮੇਰਾ ਸਾਥ ਦਵੋ ਤਾਂ ਜੋ ਮੈਂ ਰਸਤੇ ਵਿੱਚ ਕੋਈ ਤੰਗੀ ਪਰੇਸ਼ਾਨੀ ਨਾ ਹੋ ਸਕੇ ਠੀਕ ਐ ਮੈਂ ਤੁਹਾਨੂੰ ਪਿੱਛੇ ਵੀ ਟਾਈਮ ਕੋਲ ਕਰ ਸਕਦਾ ਠੀਕ ਹ ਤੇ ਮੈਂ ਐਦਾਂ ਨਾ ਮੇਰਾ ਜਿਹੜਾ ਟਾਈਮ ਜਾਣਦਾ ਉਹ ਅੱਠ ਕੁ ਵਜੇ ਮੈਂ ਜਾਣਾ ਚਾਹੁੰਦਾ ਚੋਦਾਂ ਤਰੀਕ ਨੂੰ ਤੇ ਤਾਂ ਜੋ ਮੈਂ ਦੱਸ ਦਿਓ ਜਿੰਨੀਆਂ ਵੀ ਸਾਰੀਆਂ ਅਵੇਲੇਬਲ ਟ੍ਰੇਨਾਂ ਹੈਗੀਆਂ ਨਾ ਤੁਸੀਂ ਫਿਰ ਵੀ ਮੈਨੂੰ ਬੈਕ ਮੇਰੇ ਵਟਸਐਪ ਨੰਬਰ ਤੇ ਮੈਨੂੰ ਸਾਰੀ ਡਿਟੇਲ ਸੈਂਡ ਕਰ ਦਿਓ ਤਾਂ ਜੋ ਮੇਰਾ ਜਾ ਆਣ ਜਾਣਾ ਆਸਾਨ ਹੋ ਸਕੇ ਉਸ ਹਿਸਾਬ ਨਾਲ ਬੁੱਕ ਕਰਾ ਸਕਾ ਤੇ ਤੁਸੀਂ ਮੈਨੂੰ ਦੱਸ ਦੇ ਮੈਂ ਉਸ ਹਿਸਾਬ ਨਾਲ ਤੁਸੀਂ ਬੁਕ ਕਰ ਦਿਓ ਟਰੇਨ ਤੇ ਮੈਂ ਫਿਰ ਤੁਹਾਨੂੰ ਦੱਸ ਦਿੰਦਾ ਠੀਕ ਐ ਜੀ